ਮੈਂ ਜਦੋਂ ਘਰ ਦੇ ਵਿੱਚ ਕੰਮ ਕਰਦੀ ਹਾਂ ਤਾਂ ਮੈਂ ਆਪਣਾ ਮਨੋਰੰਜਨ ਹੈਗਾ ਉਹ ਮੈਂ ਗਾਣੇ ਸੁਣ ਕੇ ਕਰਦੀ ਹਾਂ ਮੈਂ ਆਪਣੇ ਫੋਨ ਦੀ ਜਿਹੜੀ ਬਲੂਟੁੱਥ ਹੈ ਮੈਂ ਆਪਣੇ ਸਪੀਕਰ ਦੇ ਬਲੂਟੁੱਥ ਨਾਲ ਅਟੈਚ ਕਰ ਕੇ ਆਪਣੇ ਫੋਨ ਵਿੱਚ ਉਹ ਗਾਣੇ ਜਿਹੜੇ ਹੈਗੇ ਸੁਣਨੇ ਸੁਣਦੀ ਹਾਂ ਅਤੇ ਉਹਦੇ ਵਿੱਚੋਂ ਕਈ ਗਾਣੇ ਕਈ ਤਰ੍ਹਾਂ ਦੇ ਗਾਣੇ ਨੇ ਜਿਵੇਂ ਕੁਛ ਜਿਹੜੇ ਹੈਗੇ ਨੇ ਹਿਪ ਹੋਪ ਗਾਣੇ ਨੇ ਕੁਛ ਅ ਸੈਡ ਨੇ ਕੁਛ ਰੋਮੈਂਟਿਕ ਨੇ ਅਤੇ ਕੁਝ ਜਿਹੜੇ ਹੈਗੇ ਧਾਕੜ ਵਾਲੇ ਵੀ ਗਾਣੇ ਨੇ ਅਤੇ ਅ ਕਈ ਸਥਾਨਕ ਭਾਸ਼ਾ ਦੇ ਵਿੱਚ ਨੇ ਜਿਵੇਂ ਕੁਛ ਪੰਜਾਬੀ ਗਾਣੇ ਨੇ ਕੁਛ ਹਿੰਦੀ ਨੇ ਅਤੇ ਕੁਛ ਇੰਗਲਿਸ਼ ਨੇ ਸਾਰੇ ਮਿਕਸਿੰਗ ਗਾਣੇ ਚੱਲਦੇ ਨੇ ਅਤੇ ਮੈਨੂੰ ਜਿਹੜਾ ਹੈਗਾ ਬੜਾ ਚੰਗਾ ਲੱਗਦਾ ਜਦੋਂ ਮੈਂ ਆਪਣੇ ਘਰ ਦੇ ਵਿੱਚ ਕੰਮ ਰਹੀ ਹੁੰਦੀ ਹਾਂ ਅਤੇ ਨਾਲ ਦੀ ਨਾਲ ਮੈਂ ਕੋਈ ਅ ਗਾਣੇ ਸੁਣਾਂ ਅਤੇ ਕਦੇ ਕਦੇ ਮੈਂ ਅ ਕੰਮ ਕਰਦੇ ਕਰਦੇ ਕਦੇ ਕਦੇ ਮੈਂ ਕੋਈ ਪੋਡਕਾਸਟ ਵੀ ਸੁਣ ਲੈਂਦੀ ਹਾਂ ਯੂਟੀਊਬ ਚੈਨਲ ਉੱਤੇ ਅਤੇ ਮੈਂ ਜਿਹੜਾ ਹੈਗਾ ਉਹਨਾਂ ਤੋਂ ਕਿਉਂਕਿ ਪੋਡਕਾਸਟ ਤੋਂ ਕਈ ਤਰ੍ਹਾਂ ਦੀਆਂ ਜਿਹੜੀਆਂ ਸ ਚੀਜ਼ਾਂ ਨੇ ਉਹ ਸਿੱਖਣ ਨੂੰ ਮਿਲਦੀਆਂ ਅਤੇ ਆਪਣੇ ਗਿਆਨ ਦੇ ਵਿੱਚ ਵਾਧਾ ਹੁੰਦਾ ਅਤੇ ਮੈਂ ਪ੍ਰੈਫਰ ਕਰਦੀ ਹਾਂ ਘਰ ਦੇ ਕੰਮ ਕਰਦੇ ਵਕਤ ਜਾਂ ਤਾਂ ਪੋਡਕਾਸਟ ਸੁਣੀ ਜਾਵੇ ਜਾਂ ਫਿਰ ਗਾਣੇ ਸੁਣੇ ਜਾਣ ਅਤੇ ਮੈਂ ਦੋਨਾਂ ਨੂੰ ਹੀ ਜਿਹੜਾ ਹੈਗਾ ਟਾਈਮ ਦਿੰਨੀ ਹਾਂ ਅਤੇ ਦੋਨਾਂ ਨੂੰ ਹੀ ਟਰਾਈ ਕਰਦੇ ਦੋਨੋਂ ਹੀ ਇਹ ਚੀਜ਼ਾਂ ਹੋ ਜਾਣ ਅਤੇ ਉਸ ਤੋਂ ਇਲਾਵਾ ਜਿਹੜੇ ਹੈਗੇ ਆ ਮੈਂ ਕਈ ਲੋਕ ਦੇਖੇ ਨੇ ਜਿਹੜੇ ਕੰਮ ਕਰਦੇ ਕਰਦੇ ਗੀਤ ਲੋਕ ਲੋਕ ਗੀਤ ਵੀ ਗਾਉਂਦੇ ਨੇ ਅਤੇ ਉਹਨਾਂ ਵਿੱਚੋਂ ਮੇਰੇ ਦਾਦੀ ਇੱਕ ਨੇ ਉਹ ਜਿਹੜੇ ਹੈਗੇ ਹੈ ਕਦੇ ਕਦੇ ਜਦੋਂ ਕੰਮ ਕਰ ਰਹੇ ਹੁੰਦੇ ਨੇ ਘਰ ਦੇ ਵਿੱਚ ਜਿਵੇਂ ਅਗਰ ਉਹ ਜਿਹੜਾ ਸਾਡੇ ਜਿਵੇਂ ਚੱਕੀ ਹੈ ਅਤੇ ਚੱਕੀ ਦੇ ਵਿੱਚ ਜਦੋਂ ਆਟਾ ਪੀਸਦੇ ਨੇ ਤਾਂ ਉੱਥੇ ਜਿਹੜਾ ਹੈ ਕਦੇ ਕਦੇ ਉਹ ਲੋਕ ਗੀਤ ਗਾਉਂਦੇ ਨੇ ਅਤੇ ਮੈਨੂੰ ਬੜਾ ਚੰਗਾ ਲੱਗਦਾ ਉਹ ਲੋਕ ਗੀਤ ਸੁਣਨੇ ਅਤੇ ਮੈਂ ਉਹਨਾਂ ਨੂੰ ਕਹਿੰਦੀ ਵੀ ਹਾਂ ਕਿ ਮੈਨੂੰ ਵੀ ਸਿਖਾਓ ਹਾਲਾਂਕਿ ਮੈਂ ਇੰਨਾ ਜ਼ਿਆਦਾ ਮਤਲਬ ਨਹੀਂ ਆਉਂਦੇ ਮੈਨੂੰ ਲੋਕ ਗੀਤ ਪਰ ਮੈਂ ਕੋਸ਼ਿਸ਼ ਕਰਦੀ ਹਾਂ ਕਿ ਮੈਂ ਵੀ ਸਿੱਖਾਂ ਉਹਨਾਂ ਦੇ ਲੋਕ ਗੀਤ ਅਤੇ ਉਹ ਜਦੋਂ ਗਾਉਂਦੇ ਨੇ ਤਾਂ ਬੜੇ ਸੁਰ ਦੇ ਵਿੱਚ ਗਾਉਂਦੇ ਅਤੇ ਮੈਂ ਬੜਾ ਚੰਗਾ ਲੱਗਦਾ ਉਹ ਸੁਣ ਕੇ ਤੇ ਮੈਨੂੰ ਉਹ ਖੁਸ਼ ਵੀ ਖੁਸ਼ੀ ਹੁੰਦੀ ਹੈ ਕਿ ਲੋਕ ਆਪਣੇ ਜਿਹੜੇ ਹੈਗੇ ਹੈ ਲੋਕ ਗੀਤ ਨੂੰ ਜਾਂ ਫਿਰ ਆਪਣੀ ਜਿਹੜੀ ਪ੍ਰੰਪਰਾ ਉਹਨੂੰ ਨਹੀਂ ਭੁੱਲ ਰਹੇ ਅਤੇ ਉਹਨਾਂ ਨੂੰ ਨਾਲ ਦੇ ਨਾਲ ਲੈ ਕੇ ਚੱਲ ਰਹੇ ਨੇ